ਪੰਜਾਬ ਵਿੱਚ ਖਾਸ ਮੌਕੇ ਤਿਉਹਾਰ ਜਾਂ ਸ ਸਮਾਗਮ 'ਤੇ ਡਾਂਸ ਕੀਤਾ ਜਾਂਦਾ ਹੈ ਜਿਵੇਂ ਵਿਆਹਾਂ ਵਿੱਚ ਭੰਗੜਾ ਕੀਤਾ ਜਾਂਦਾ ਹੈ ਤੀਆਂ ਮਨਾਈਆਂ ਜਾਂਦੀਆਂ ਹਨ ਲੋਹੜੀ ਵਾਲੇ ਵੀ ਮੁੰਡੇ ਦੀ ਖੁਸ਼ੀ 'ਤੇ ਡਾਂਸ ਕੀਤਾ ਜਾਂਦਾ ਹੈ ਇਹ ਡਾਂਸ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਸ ਡਾਂਸ ਨਾਲ ਆਪਣਾ ਪੰਜਾਬ ਬਹੁਤ ਹੀ ਕਲਚਰਿਕ ਬਣ ਜਾਂਦਾ ਹੈ ਇਸੇ ਤਰ੍ਹਾਂ ਆਪਾਂ ਅਲੱਗ ਅਲੱਗ ਤਿਉਹਾਰਾਂ 'ਤੇ ਅਲੱਗ ਅਲੱਗ ਤਰੀਕੇ ਦਾ ਡਾਂਸ ਕਰਦੇ ਹਾਂ